ਮੈਂ ਬਚਪਨ ਵਿਚ ਆਪਣੇ ਦਾਦਾ ਦਾਦੀ ਤੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਕੁਛ ਸੁਣਿਆ ਹੈ ਕਿ ਉਹਨਾਂ ਦਾ ਸਾਡੇ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹ ਉਹਨਾਂ ਨੇ ਬਹੁਤ ਸਾਰੇ ਲੜਾਈਆਂ ਲੜੀਆਂ ਜੋ ਕਿ ਅੰਗਰੇਜ਼ਾਂ ਦੇ ਵਿਰੁੱਧ ਸਨ ਤਾਂ ਕਿ ਉਹ ਆਪਣੇ ਦੇਸ਼ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਸਕਣ ਅਤੇ ਜੋ ਵੀ ਧੋਖਾਧੜੀ ਸਾਡੇ ਦੇਸ਼ ਵਿੱਚ ਵਾਪਰ ਰਹੇ ਸੀ ਉਹਨੂੰ ਦੂਰ ਕਰ ਸਕਣ ਅਤੇ ਮਹਾਰਾਜਾ ਰਣਜੀਤ ਸਿੰਘ ਕੀ ਉਹ ਇਕੱਲੇ ਅਜਿਹੇ ਇਨਸਾਨ ਸਨ ਜਿਹਨਾਂ ਨੇ ਜੋ ਕਿ ਪੂਰੀ ਦੁਨੀਆਂ ਨੇ ਲੜ ਗਏ ਸਿਰਫ ਭਾਰਤ ਦੀ ਆਜ਼ਾਦੀ ਲਈ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਜਾਂ ਫਿਰ ਪੰਜਾਬ ਦਾ ਸ਼ੇਰ ਵੀ ਕਿਹਾ ਜਾਂਦਾ ਹੈ